ਕੈਮਰਾ ਸਾਡੇ ਲਈ ਬਹੁਤ ਹੀ ਜ਼ਿਆਦਾ ਲੋੜਵੰਦ ਚੀਜ਼ ਹੈ ਇਸ ਨਾਲ ਅਸੀਂ ਆਪਣੇ ਜੀਵਨ ਦੇ ਜ਼ਰੂਰੀ ਪਲਾਂ ਨੂੰ ਆਪਣੇ ਕੋਲ ਸੰਜੋਅ ਕੇ ਰੱਖ ਸਕਦੇ ਹਨ ਕੈਮਰੇ ਦੁਆਰਾ ਖਿੱਚੀ ਗਈ ਫੋਟੋ ਸਾਡੇ ਨਾਲ ਹਮੇਸ਼ਾ ਰਹਿੰਦੀ ਹੈ ਅਤੇ ਸਾਨੂੰ ਉਸ ਦਿਨ ਦੀ ਯਾਦ ਦਿਵਾਉਂਦੀ ਹੈ ਇਹ ਸਾਡੀਆਂ ਯਾਦਾਂ ਨੂੰ ਦੁਬਾਰਾ ਨਵਾਂ ਕਰ ਦਿੰਦੀਆਂ ਹਨ ਜਿਵੇਂ ਕਿ ਆਪਾਂ ਉਹੀ ਸਮਾਂ ਜਿਊ ਰਹੇ ਹਨ ਪਹਿਲਾਂ ਤਾਂ ਕੈਮਰਿਆਂ ਬਹੁਤ ਹੀ ਜ਼ਿਆਦਾ ਮਹਿੰਗੇ ਹੁੰਦੇ ਸਨ ਪਰ ਅੱਜ ਕੈਮਰਾ ਫੋਨ ਵਿੱਚ ਹੀ ਆ ਗਿਆ ਹੈ ਅਤੇ ਫੋਨ ਦੇ ਨਾਲ ਹੀ ਸਾਨੂੰ ਇੱਕ ਕੈਮਰਾ ਮਿਲ ਜਾਂਦਾ ਹੈ ਇਹ ਕੈਮਰਾ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕ ਅਤੇ ਇਸ ਨਾਲ ਅਸੀਂ ਆਪਣੇ ਜ਼ਿੰਦਗੀ ਦੇ ਹਰ ਭਾਗ ਨੂੰ ਰਿਕੋਡ ਕਰ ਸਕਦੇ ਹਨ ਕੈਮਰੇ ਨਾਲ ਅਸੀਂ ਹਰ ਤਰ੍ਹਾਂ ਦੀਆਂ ਫੋਟੋਆਂ ਖਿੱਚ ਸਕਦੇ ਹਨ ਜਿਵੇਂ ਕਿ ਕਿਸੇ ਵਿਆਹ ਜਾਂ ਪ੍ਰੋਗਰਾਮ ਦੀਆਂ ਅਤੇ ਇਸ ਨਾਲ ਅਸੀਂ ਕਿਸ ਕਿਸੇ ਵੀ ਚੀਜ਼ ਜਿਵੇਂ ਕਿ ਡੋਕੂਮੈਂਟ ਵਗੈਰਾ ਦੀ ਫੋਟੋ ਖਿੱਚ ਕੇ ਆਪਣੇ ਕੋਲ ਰੱਖ ਸਕਦੇ ਹਨ ਅਤੇ ਮੋਬਾਇਲ ਦੇ ਕੈਮਰੇ ਨਾਲ ਖਿੱਚੀ ਗਈ ਫੋਟੋ ਇੱਕ ਇੱਕ ਸਾਡੇ ਕੋਲ ਡਿਜੀਟਲ ਫੋਰਮੈਟ ਵਿੱਚ ਰਹਿ ਜਾਂਦੀ ਹੈ ਜਿਸ ਨੂੰ ਅਸੀਂ ਅੱਗੇ ਵੀ ਵਰਤ ਸਕਦੇ ਹਨ ਅਸੀਂ ਇਸ ਨੂੰ ਇੱਕ ਪੈਨ ਡਰਾਈਵ ਵਿੱਚ ਰੱਖ ਸਕਦੇ ਹਨ ਇੱਕ ਪੈਨ ਡਰਾਈਵ ਵਿੱਚ ਹਜ਼ਾਰਾਂ ਹੀ ਫੋਟੋਆਂ ਅਸੀਂ ਸੰਜੋਗ ਕੇ ਰੱਖ ਸਕਦੇ ਹਨ ਤਾਂ ਕਿ ਆਪਾਂ ਅੱਗੇ ਜਾ ਕੇ ਉਹ ਪੁਰਾਣੀ ਯਾਦਾਂ ਦਾ ਲੁਤਫ਼ ਉਠਾ ਸਕੀਏ ਇਹ ਪੁਰਾਣੀ ਯਾਦਾਂ ਨੂੰ ਸੰਜੋਗ ਕੇ ਰੱਖਣ ਵਿੱਚ ਕੈਮਰੇ ਦਾ ਬਹੁਤ ਬੜਾ ਹੱਥ ਹੈ ਅਤੇ ਅੱਗੇ ਵੀ ਇਹ ਕੈਮਰਾ ਸਾਡੀ ਮਦਦ ਦਿੰਦਾ ਰਹੇਗਾ